ਪੰਜਾਬ ਵਿੱਚ ਐਲੋਪੈਥਿਕ ਦਵਾਈਆਂ ਨਾ ਵਰਤ ਕੇ ਦੇਸੀ ਦਵਾਈਆਂ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ ਕਿਉਂਕਿ ਇਸ ਨਾਲ ਕੋਈ ਵੀ ਸਰੀਰਕ ਪ੍ਰੋਬਲਮ ਨਹੀਂ ਹੁੰਦੀ ਜੋ ਕਿ ਲੀਵਰ ਨੂੰ ਸਹੀ ਰੱਖਦੀਆਂ ਨੇ ਅਗਰ ਐਲੋਪੈਥੀਕ ਯੂਜ ਕਰਦੇ ਹਾਂ ਤਾਂ ਉਸ ਨਾਲ ਲੀਵਰ ਨੂੰ ਬਹੁਤ ਪ੍ਰੋਬਲਮ ਹੁੰਦੀ ਹੈ ਅਤੇ ਇਹ ਸਾਨੂੰ ਘਰ ਦੇ ਵਿੱਚ ਹੀ ਭਾਵ ਕਿਚਨ 'ਚੋਂ ਹੀ ਬਹੁਤ ਸਾਰੀਆਂ ਜਿਹੜੀਆਂ ਨੇ ਬਿਮਾਰੀਆਂ ਦਾ ਹੱਲ ਦੇਸੀ ਨੁਸਖੇ ਨਾਲ ਅਸੀਂ ਆਪਣਾ ਪ੍ਰੋਬਲਮ ਹੈ ਜਿਹੜਾ ਉਹ ਸੋਲਵ ਕਰਦੇ ਹਾਂ